ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਨੂੰ ਪੂਰੇ ਸੰਸਾਰ ਵਿੱਚ ਉੱਚਾ ਦਰਜਾ ਦਿੱਤਾ ਗਿਆ ਹੈ ਭਾਰਤ ਵਿੱਚ ਸੱਭਿਆਚਾਰ ਦੇ ਅਧਾਰ 'ਤੇ ਪੰਜਾਬ ਸਭ ਤੋਂ ਅਮੀਰ ਰਾਜ ਹੈ ਪੰਜਾਬੀ ਚਿੱਤਰਕਾਰੀ ਵਿਚ ਤਰਾਂ ਤਰ੍ਹਾਂ ਦੀਆਂ ਦਸਤਕਾਰੀਆਂ ਬਣਾਈਆਂ ਗਈਆਂ ਹਨ ਦਸਤਕਾਰੀ ਜ਼ਿਆਦਾਤਰ ਪਿੰਡਾਂ ਦੀਆਂ ਔਰਤਾਂ ਦੁਆਰਾ ਹੀ ਕੀਤੀ ਜਾਂਦੀ ਸੀ ਸਭ ਤੋਂ ਮਹੱਵਤਪੂਰਨ ਦਸਤਕਾਰੀ ਪੰਜਾਬ ਦੀ ਫੁਲਕਾਰੀ ਹੈ ਇਹ ਫੁਲਕਾਰੀ ਪੰਜਾਬ ਦੀਆਂ ਮੁਟਿਆਰਾਂ ਦੁਆਰਾ ਕੱਢੀ ਜਾਂਦੀ ਸੀ ਇਸ ਤੋਂ ਇਲਾਵਾ ਜੋਟੀਆਂ ਅਤੇ ਪਰਾਂਦੀਆਂ ਵੀ ਬਣਾਈਆਂ ਜਾਂਦੀਆਂ ਸਨ ਪੰਜਾਬ ਨੂੰ ਆਮ ਤੌਰ 'ਤੇ ਪੰਜਾਂ ਦਰਿਆਵਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਪੰਜਾਬ ਦਾ ਧਰਮ ਸਿੱਖੀਜ਼ਮ ਤੇ ਹੈ ਅਧਾਰਿਤ ਹੈ ਜੋ ਕੀ ਸਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰਾਪਤ ਹੋਇਆ ਹੈ ਜੋ ਕਿ ਸਿੱਖਾਂ ਦੇ ਪਹਿਲੇ ਗੁਰੂ ਸਨ ਉਹਨਾਂ ਦਾ ਜਨਮ ਚੌਦ੍ਹਾਂ ਸੌ ਉਣਹੱਤਰ ਈਸਵੀ ਨੂੰ ਹੋਇਆ ਸੀ ਅਤੇ ਸਿੱਖਾਂ ਦੇ ਦਸਵੇਂ ਗੁਰੂ ਜੋ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ ਉਹਨਾਂ ਨੇ ਸਿੱਖਾਂ ਨੂੰ ਸਿੰਘਾਂ ਦੀ ਕੌਮ ਬਣਾਇਆ ਸੀ ਸਿੱਖਾਂ ਦੀ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਦੁਆਰਾ ਲਿਖੀ ਗਿਆ ਹੈ ਗੁਰੂ ਅਰ ਨਾਨਕ ਦੇਵ ਜੀ ਦੇ ਜੀਵਨ 'ਤੇ ਸਾਖੀ ਲਿਖੀ ਗਈ ਸੀ ਜੋ ਕਿ ਉਹਨਾਂ ਦੇ ਪੂਰੇ ਜੀਵਨ 'ਤੇ ਅਧਾਰਿਤ ਹੈ ਪੰਜਾਬ ਦੇ ਜੋ ਪੁਰਾਣੇ ਲੋਕ ਸੀ ਉਹ ਬਹੁਤ ਸਰਲ ਅਤੇ ਸਾਦੇ ਸਨ ਉਸ ਸਮੇਂ ਵਿੱਚ ਕੱਪੜੇ ਬਣਾਉਣ ਵਾਲੀ ਮਸ਼ੀਨ ਨਹੀਂ ਹੁੰਦੀ ਸੀ ਉਹ ਚਰਖਾ ਕੱਤਦੇ ਸਨ ਜੋ ਆਮ ਲੋਕ ਸਨ ਉਹ ਖੱਦਰ ਦੇ ਕੱਪੜੇ ਪਾਉਂਦੇ ਸਨ ਅਤੇ ਜੋ ਥੋੜ੍ਹੇ ਅਮੀਰ ਸਨ ਉਹ ਰੇਸ਼ਮ ਦੇ ਕੱਪੜੇ ਪਾਉਂਦੇ ਸਨ ਪੁਰਾਣੇ ਸਮੇਂ ਵਿੱਚ ਲੋਕ ਜਾਨਵਰਾਂ ਦੀ ਵੀ ਪੂਜਾ ਕਰਦੇ ਸਨ ਜਿਵੇਂ ਗਊ ਮਾਤਾ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ ਸ਼ੇਰ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸਨ ਪੁਰਾਣੇ ਸਮੇਂ ਵਿੱਚ ਚਿੱਤਰਕਾਰੀ ਵਿੱਚ ਕਈ ਤਰ੍ਹਾਂ ਦੇ ਪਸ਼ੂ ਪਕਸ਼ੀ ਬਣਾਏ ਜਾਂਦੇ ਸਨ ਜਿਵੇਂ ਘੋੜੇ ਤੋਤੇ ਮੋਰ ਚਿੜੀਆਂ ਪੱਥਰ ਦੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਸੀ ਕੁੜੀਆਂ ਕੰਧਾਂ 'ਤੇ ਚਿੱਤਰਕਾਰੀ ਕਰਦੀਆਂ ਸਨ ਪੁਰਾਣੇ ਸਮੇਂ ਵਿੱਚ ਰਾਤ ਨੂੰ ਦੀਵਿਆਂ ਦੇ ਚਾਨਣ ਹੇਠ ਚਿੱਤਰਕਾਰੀ ਕੀਤੀ ਜਾਂਦੀ ਸੀ ਪੰਜਾਬ ਦੀ ਦਿਹਾਤੀ ਕਲਾ ਆਪਣੇ ਆਪ ਵਿੱਚ ਇੱਕ ਸੰਪੂਰਨ ਕਲਾ ਹੈ ਜੋ ਅੱਜ ਤੱਕ ਜੀਵਤ ਹੈ ਧੰਨਵਾਦ